ਹਾਂਜੀ ਤੁਸੀਂ ਫੋਟੋ ਸਟੂਡੀਓ ਤੋਂ ਬੋਲਦੇ ਹੋ ਹਾਂਜੀ ਸਾਡੇ ਘਰ ਨਾ ਇੱਕ ਫ਼ੰਕਸ਼ਨ ਸੀ ਦਸ ਦਿਸੰਬਰ ਦਾ ਅਤੇ ਤੁਸੀਂ ਓਦੋਂ ਫ੍ਰੀ ਹੋਓਂਗੇ ਮਤਲਬ ਕਵਰੇਜ ਕਰ ਦਓਂਗੇ ਸਾਡੇ ਫ਼ੰਕਸ਼ਨ ਨੂੰ ਹਾਂਜੀ ਫੇਰ ਉਹ ਨਾ ਦਸ ਦਿੰਸਬਰ ਦਾ ਫ਼ੰਕਸ਼ਨ ਹੈ ਅਤੇ ਮਤਲਬ ਤੁਹਾਨੂੰ ਸੁਬ੍ਹਾ ਸੁਬ੍ਹਾ ਈ ਆਣਾ ਪਏਗਾ ਕਿਉਂਕਿ ਵੀ ਫੇਰ ਓਸ ਤੋਂ ਪਹਿਲਾਂ ਵੀ ਵੈਸੇ ਤਾਂ ਇੰਗੇਜਮੈਂਟ ਤਾਂ ਅੱਠ ਵਜੇ ਦੀ ਹੈ ਰਾਤ ਦੀ ਲੇਕਿਨ ਆਉਣਾ ਤੁਹਾਨੂੰ ਸੁਬ੍ਹਾ ਸੁਬ੍ਹਾ ਹੀ ਪਏਗਾ ਕਿਉਂਕਿ ਪਹਿਲਾਂ ਵੀ ਅਸੀਂ ਕੋਈ ਫ਼ੰਕਸ਼ਨ ਕਰਨੇ ਹੈ ਹਾਂਜੀ ਸੁਬ੍ਹਾ ਤਾਂ ਜਦੋਂ ਤੁਸੀਂ ਆਓਂਗੇ ਪਹਿਲੇ ਤਾਂ ਆਪਾਂ ਜਿਹੜੀ ਹੁੰਦਾ ਜਿਵੇਂ ਐਂਟਰੀ ਗੇਟ 'ਤੇ ਹੀ ਪਹਿਲਾਂ ਡੈਕੋਰੇਸ਼ਨ ਵਗੈਰਾ ਜਿਵੇਂ ਹੋਈ ਹੋਏਗੀ ਓਥੋਂ ਹੀ ਤੁਸੀਂ ਸਟਾਟ ਕਰਨਾ ਹੈ ਓਸ ਤੋਂ ਬਾਦ ਜਿਵੇਂ ਵੈਸੇ ਹੀ ਮਹਿੰਦੀ ਦਾ ਫ਼ੰਕਸ਼ਨ ਵੀ ਹੈ ਥੋ ਛੋਟਾ ਜਿਆ ਅਤੇ ਉਸ ਤੋਂ ਬਾਅਦ ਡਾਂਸ ਵਗੈਰਾ ਦੀ ਵੀਡੀਓ ਤੁਸੀਂ ਕਵਰੇਜ ਕਰੋਂਗੇ ਰਾਤ ਨੂੰ ਮਤਲਬ ਜਿਵੇਂ ਇੰਗੇਜਮੈਂਟ ਹੈਗੀ ਹੈ ਅਤੇ ਉਹ ਉਹਨੂੰ ਵੀ ਜਿਵੇਂ ਕੱਪਲ ਆਏਗਾ ਉਹਨਾਂ ਦੀ ਐਂਟਰੀ ਦੀ ਜਿਵੇਂ ਤੁਸੀਂ ਕਰਨੀ ਹੈ ਕਵਰੇਜ ਉਹ ਤੋਂ ਬਾਅਦ ਜਦੋਂ ਹਾਂਜੀ ਹਾਂਜੀ ਉਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਮਤਲਬ ਰਿੰਗ ਸੈਰਾਮਨੀ ਹੋਏਗੀ ਅਤੇ ਉਹ ਵੀ ਸਾਰੀ ਅਤੇ ਬਾਕੀ ਮਤਲਬ ਜਿਵੇਂ ਡਾਂਸ ਵਗੈਰਾ ਮਤਲਬ ਲਾਸਟ ਮੂਮੈਂਟ ਤੱਕ ਲਾਸਟ ਪਲ ਤੱਕ ਮਤਲਬ ਆਖਰੀ ਪਲ ਤੱਕ ਤੁਸੀਂ ਵਧੀਆ ਤਰੀਕੇ ਨਾਲ ਮਤਲਬ ਕਵਰੇਜ ਕਰਨੀ ਚਾਹੀਦੀ ਹੈ ਵੀ ਸਾਨੂੰ ਕੋਈ ਸ਼ਿਕਾਇਤ ਨਾ ਆਵੇ ਤੁਹਾਡੇ ਕੋਲੋਂ ਹਾਂਜੀ ਹਾਂਜੀ ਤਾਂ ਕਿ ਨਾ ਵੀ ਮਤਲਬ ਕਿ ਜਿਵੇਂ ਤੁਹਾਡੀ ਮਤਲਬ ਵੇਖਣ ਦੀ ਉਹ ਅਤੇ ਸਾਰਿਆਂ ਨੂੰ ਵਧੀਆ ਲੱਗੇ ਤਾਂ ਕਿ ਸਾਰੇ ਜਣੇ ਕਹਿਣ ਵੀ ਕਿਹੜਾ ਸਟੂਡੀਓ ਵਾਲਾ ਕੀਤਾ ਸੀ ਵੀ ਜਿਹਨੇ ਬਹੁਤ ਵਧੀਆ ਕਵਰੇਜ ਹਾਂਜੀ ਹਾਂਜੀ ਬਸ ਆਪਾਂ ਨੂੰ ਤਾਂ ਇਹ ਨਹੀਂ ਜੀ ਪਹਿਲਾਂ ਤੁਸੀਂ ਘਰੇ ਆਓਂਗੇ ਵੈਸੇ ਪਰ ਆਪਾਂ ਇੱਕ ਹੋਟਲ ਕੀਤਾ ਹੋਇਆ ਹੈ ਓਥੇ ਹੋਏਗੀ ਇੰਗੇਜਮੈਂਟ ਤਾਂ ਹਾਂਜੀ ਪਰ ਤੁਹਾਨੂੰ ਟਾਈਮ ਨਾਲ ਪਹੁੰਚਣਾ ਪਏਗਾ ਕਿਉਂਕਿ ਕਈ ਵਾਰੀ ਰਿਸ਼ਤੇਦਾਰ ਪਹਿਲਾਂ ਟਾਈਮ ਨਾਲ ਆ ਜਾਂਦੇ ਹੈ ਅਤੇ ਫੇਰ ਅੱਛਾ ਨਹੀਂ ਲੱਗਦਾ ਐਵੇਂ ਅਤੇ ਹਾਂਜੀ ਉਹ ਤਰੀਕੇ ਨਾਲ ਸੁਬ੍ਹਾ ਤੁਸੀਂ ਦਸ ਵਜੇ ਤੱਕ ਸਵੇਰੇ ਦਸ ਵਜੇ ਤੱਕ ਆ ਜਾਇਆ ਜੇ ਮੈਨੂੰ ਤੁਹਾਨੂੰ ਵਾਰ ਵਾਰ ਫੋਨ ਕਰਕੇ ਬੁਲਾਉਣਾ ਨਾ ਪਵੇ ਕਿਉਂਕਿ ਐਮੇ ਫੇਰ ਮੈਨੂੰ ਵੀ ਦਿੱਕਤ ਹੋਏਗੀ ਅਤੇ ਤੁਹਾਨੂੰ ਵੀ ਦਿੱਕਤ ਹੋਏਗੀ ਹਾਂਜੀ ਹਾਂਜੀ ਬਸ ਕੰਮ ਵਧੀਆ ਹੋਣਾ ਚਾਹੀਦਾ ਪੈਸੇ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਕਿੰਨੇ ਪੈਸੇ ਲੈਂਦੇ ਹੋ ਵੈਸੇ ਤੁਸੀਂ ਹਾਂਜੀ ਅਤੇ ਤੁਸੀਂ ਮੈਨੂੰ ਇੱਕ ਦੋ ਦਿਨ ਪਹਿਲਾਂ ਆ ਕੇ ਮਤਲਬ ਆਪ ਦਾ ਕੁਛ ਕੰਮ ਦਿਖਾ ਸਕਦੇ ਓਂ ਕੁਛ ਪਰਾਨਾ ਕੰਮ ਜਿਵੇਂ ਓਹੋ ਜਿਹਾ ਤੁਸੀਂ ਕੀਤਾ ਹੋਵੇ ਮਤਲਬ ਕਿਸ ਤਰ੍ਹਾਂ ਤੁਸੀਂ ਹਾਂਜੀ ਕਿਉਂਕਿ ਓਦੋਂ ਰਿੰਗ ਸੈਰਾਮਨੀ 'ਤੇ ਆਪਾਂ ਪੋਜ ਵਗੈਰਾ ਵੀ ਉਨ੍ਹਾਂ ਦੇ ਕਰਾਂਗੇ ਨਾ ਜੋ ਕੱਪਲ ਹੈਗੇ ਹੈ ਹਾਂਜੀ ਅਤੇ ਆਉਣਾ ਹਾਂਜੀ ਹਾਂਜੀ ਹਾਂਜੀ ਹਾਂਜੀ ਪਹਿਲਾਂ ਤੁਸੀਂ ਮੈਨੂੰ ਕੰਮ ਚੈੱਕ ਕਰਵਾ ਦਿਆ ਜੇ ਮੈਨੂੰ ਤੁਹਾਡਾ ਕੰਮ ਵਧੀਆ ਲੱਗਿਆ ਤਾਂ ਫੇਰ ਜ਼ਰੂਰ ਤੁਹਾਨੂੰ ਹੀ ਮਤਲਬ ਕੀਤਾ ਜਾਏਗਾ ਹਾਂਜੀ ਹਾਂਜੀ ਅਤੇ ਤੁਸੀਂ ਪਹੁੰਚ ਜੁੰਗੇ ਫੇਰ ਦਸ ਵਜੇ ਤਾਂ ਓਸ ਦਿਨ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਬਹੁਤ ਮੇਹਰਬਾਨੀ